ਪੰਜਾਬ ਵਿੱਚ ਪਸ਼ੂਆਂ ਤੋਂ ਮਾਲੀਆ ਪੈਦਾ ਕਰਨ ਲਈ ਬਹੁਤ ਸਾਰੇ ਸਾਰਥਕ ਧੰਦੇ ਅਪਣਾਏ ਜਾਂਦੇ ਹਨ ਜੋ ਕਿ ਪਸ਼ੂ ਪਾਲਣ ਬੱਕਰੀਆਂ ਪਾਲਣ ਦਾ ਕੰਮ ਡੇਰੀ ਵਿਭਾਗ ਦਾ ਗਾਈਆਂ ਅਤੇ ਮੱਝਾਂ ਤੋਂ ਦੁੱਧ ਦੀ ਦੁੱਧ ਵੇਚ ਕੇ ਵੀ ਮਾਲੀਆ ਕਮਾਇਆ ਜਾਂਦਾ ਹੈ ਬੱਕਰੀਆਂ ਤੋਂ ਆਹ ਜਿਹੜੀ ਬੱਕਰੀਆਂ ਰੱਖ ਕੇ ਉਹਨਾਂ ਨੂੰ ਅੱਗੇ ਸੇਲ ਕਰਕੇ ਜਦੋਂ ਗਿਣਤੀ ਵੱਧ ਜਾਂਦੀ ਹੈ ਤਾਂ ਮਾਲੀਆ ਕਮਾਉਂਦੇ ਹਨ ਭੇਡਾਂ ਤੋਂ ਮਾਲ ਵਾਲੇ ਜਦੋਂ ਉਹਨਾਂ ਦੀ ਉੱਨ ਵੱਧ ਜਾਂਦੀ ਹੈ ਤਾਂ ਉਸ ਨੂੰ ਕੱਟ ਕੇ ਵੀ ਬਜ਼ਾਰ ਵਿੱਚ ਵੇਚ ਕੇ ਮਾਲੀਆ ਕਮਾਉਂਦੇ ਹਨ ਊਠਾਂ ਨਾਲ ਕਿਰਾਇਆ ਊਂਠ ਗੱਡੀਆਂ ਨਾਲ ਕਿਰਾਇਆ ਵਾਣ ਵਾਹ ਕੇ ਵੀ ਮਾਲੀਆ ਕਮਾਇਆ ਜਾਂਦਾ ਹੈ ਸ ਬਹੁਤ ਸਾਰੇ ਪਸ਼ੂਆਂ ਤੋਂ ਅਲੱਗ ਅਲੱਗ ਤਰੀਕਿਆਂ ਨਾਲ ਮਾਲੀਆ ਕਮਾਇਆ ਜਾਂਦਾ ਹੈ ਮੱਝਾਂ ਗਾਵਾਂ ਤੋਂ ਦੁੱਧ ਰਾਹੀਂ ਭੇਡਾਂ ਤੋਂ ਉੱਨ ਰਾਹੀਂ ਊਠਾਂ ਤੋਂ ਖ ਬੈਲਾਂ ਤੋਂ ਖੇਤੀ ਦਾ ਕੰਮ ਲੈ ਕੇ ਵੀ ਮਾਲੀਆ ਕਮਾਇਆ ਜਾਂਦਾ ਹੈ ਪੰਜਾਬ ਵਿੱਚ ਸਾਰਾ ਤਰ੍ਹਾਂ ਦੇ ਪਸ਼ੂਆਂ ਤੋਂ ਮਾਲੀਆ ਕਮਾਇਆ ਜਾਂਦਾ ਹੈ ਜਿਸ ਵਿੱਚ ਬੱਕਰੀਆਂ ਤੋਂ ਜ਼ਿਆਦਾ ਪੈਦਾਵਾਰ ਕੀਤੀ ਜਾਂਦੀ ਹੈ ਬੱਕਰੀਆਂ ਤੋਂ ਜ਼ਿਆਦਾ ਮਾਲੀਆ ਕਮਾਇਆ ਜਾਂਦਾ ਹੈ ਘੋੜਿਆਂ ਆਦਿ ਤੋਂ ਚੰਗੇ ਬੱਚੇ ਲੈ ਕੇ ਸੇਲ ਕੀਤੇ ਜਾਂਦੇ ਹਨ ਉਸ ਤੋਂ ਵੀ ਮਾਲੀਆ ਬਹੁਤ ਆਮਦਨ ਹੁੰਦੀ ਹੈ ਅਤੇ ਮਾਲੀਆ ਕਮਾਇਆ ਜਾਂਦਾ ਹੈ ਇਸ ਕੰਮ ਨੂੰ ਉਤਸ਼ਾਹਿਤ ਕਰਨ ਲਈ ਮੇਲੇ ਪਸ਼ੂ ਮੇਲੇ ਵੀ ਕਰਾਏ ਜਾਂਦੇ ਹਨ